ਹੈਲੋ ਹੈਲੋ ਅਮਿਤ ਜੀ ਮੈਂ ਤੋਂ ਬੋਲਦਾ ਗੁਰਦਾਸਪੁਰ ਤੋਂ ਕੈਬ ਬੁਕਿੰਗ ਕਰਵਾਈ ਦੀ ਬੁਕਿੰਗ ਕਰਵਾਈ ਸੀਗੀ ਅਤੇ ਦਸ ਵਜੇ ਟਾਈਮ ਸੀਗਾ ਭਾਈ ਸਾਹਿਬ ਅਤੇ ਅਜੇ ਤੱਕ ਪਹੁੰਚੇ ਨਹੀਂ ਅੱਧਾ ਘੰਟਾ ਹੋ ਗਿਆ ਵੇਟ ਕਰਦਿਆਂ ਪਿਆ ਸਾਰੇ ਸਾਡੇ ਮੈਂਬਰ ਪਰੇ ਪਰੇਸ਼ਾਨ ਹੋ ਰਹੇ ਆ ਅਤੇ ਕੀ ਪ੍ਰੋਬਲਮ ਹੋ ਗਈ ਇੰਨੀ ਦੇਰ ਦੇਰੀ ਕਿਉਂ ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਪਰ ਹੁਣ ਦੇਖੋ ਨਾ ਸਾਡਾ ਟਾਈਮ ਤਾਂ ਵੇਸਟ ਹੋਇਆ ਨਾ ਤੁਸੀਂ ਟਾਈਮ ਨਾਲ ਤੁਹਾਡਾ ਪੁੱਜਣਾ ਫਰਜ ਬਣਦਾ ਸੀਗਾ ਮੈਂ ਮੰਨਦਾ ਹਾਂ ਕੋਈ ਨਾ ਕੋਈ ਰਸਤੇ ਵਿੱਚ ਕੋਈ ਪ੍ਰੋਬਲਮ ਹੋ ਸਕਦੀ ਆ ਕੋਈ ਅਲਟਰਨੇਟਿਵ ਅਰੇਂਜ ਕਰ ਸਕ ਅਰੇਂਜਮੈਂਟ ਕਰ ਸਕਦੇ ਸੀ ਨਾ ਅਗਰ ਤੁਹਾਨੂੰ ਪਤਾ ਸੀਗਾ ਕਿ ਤੁਹਾਡੀ ਕੈਬ 'ਚ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਉਹਦਾ ਅਲਟਰਨੇਟਿਵ ਪਹਿਲਾਂ ਲੱਭ ਕੇ ਰੱਖਦੇ ਹੁਣ ਸਾਨੂੰ ਪਰੇਸ਼ਾਨੀ ਹੋ ਰਹੀ ਹੈ ਦਸ ਵਜੇ ਦਾ ਟਾਈਮ ਸੀਗਾ ਹੁਣ ਸਾਢੇ ਦਸ ਹੋ ਗਿਆ ਤੁਸੀਂ ਆਪੇ ਲਾ ਲਓ ਹਿਸਾਬ ਵੀ ਸਾਡਾ ਇੰਨਾ ਟਾਈਮ ਜਿਹੜਾ ਵੇਸਟ ਹੋ ਗਿਆ ਉਹ ਕਿੱਦਾਂ ਐਡਜਸਟ ਹੋਣਾ ਵਾ ਚਲੋ ਠੀਕ ਆ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਕਿੰਨੇ ਵਜੇ ਤੱਕ ਪੁੱਜਦੇ ਜੇ ਪੰਜ ਮਿੰਟ ਦਸ ਮਿੰਟ ਪੰਦਰਾ ਮਿੰਟ ਦੱਸੋ ਕਿੰਨਾ ਟਾਈਮ ਲੈਂਦੇ ਹੋ ਜੇ ਗਿਆਰਾਂ ਵਜੇ ਗਿਆਰਾਂ ਵਜੇ ਤੱਕ ਤਾਂ ਬਹੁਤ ਲੇਟ ਹੋ ਜਾਣਾ ਭਾਈ ਸਾਹਿਬ ਤੁਸੀਂ ਸਾਡੇ ਟਾਈਮ ਦਾ ਵੀ ਤਾਂ ਧਿਆਨ ਰੱਖੋ ਨਾ ਇਹ ਫਿਰ ਗਲਤੀ ਕਰ ਬੈਠੇ ਅਸੀਂ ਤੁਹਾਡੇ ਨਾਲ ਬੁਕਿੰਗ ਕਰਵਾ ਕੇ ਤੁਹਾਡੇ ਕੋਲੋਂ ਗਲਤ ਗਲਤ ਬਿਹੇਵੀਅਰ ਆ ਨਾ ਤੁਹਾਡਾ ਫਿਰ ਇਸ ਤਰ੍ਹਾਂ ਥੋੜ੍ਹਾ ਚਾਹੀਦਾ ਵਾ ਪ੍ਰੋਪਰ ਸਰਵਿਸ ਮਿਲਣੀ ਚਾਹੀਦੀ ਸਾਨੂੰ ਹਾਂ ਠੀਕ ਆ ਮੈਂ ਪਹਿਲਾਂ ਪਹਿਲਾਂ ਵੀ ਤੁਹਾਡੇ ਕੋਲ ਬੁਕਿੰਗ ਕਰਵਾਈ ਆ ਉਹ ਗੱਲ ਠੀਕ ਆ ਪਰ ਪਹਿਲਾਂ ਕਦੇ ਤੁਸੀਂ ਇਸ ਤਰ੍ਹਾਂ ਕੀਤਾ ਨਹੀਂ ਇਸ ਵੇਲੇ ਤਾਂ ਬਹੁਤ ਹੀ ਖਰਾਬ ਕੀਤਾ ਚੱਲੋ ਜਿੰਨਾ ਜਲਦੀ ਹੋ ਸਕਦਾ ਪੁੱਜੋ ਹੁਣ ਅਸੀਂ ਕੋਈ ਅਲਟਰਨੇਟਿਵ ਹੋਰ ਤਾਂ ਲੱਭਣਾ ਨਹੀਂ ਹੈਗਾ ਹੁਣ ਤੁਹਾਨੂੰ ਕਾਲ ਕੀਤਾ ਵਾ ਤੁਹਾਡੇ ਨਾਲ ਬੁਕਿੰਗ ਕਰਵਾਈ ਦੀ ਆ ਅਤੇ ਤੁਹਾਡੇ ਕੋਈ ਸਰਵਿਸ ਅਸੀਂ ਲੈਣੀ ਆ ਪੁੱਜੋਂ ਟਾਈਮ ਦੇ ਨਾਲ ਫਿਰ ਚਲੀਏ ਠੀਕ ਹੈ ਜੀ ਓਕੇ ਜੀ ਸ਼ੁਕਰੀਆ